ਸਾਡੇ ਖੇਤਰ ਵਿੱਚ ਤਕਨੀਕੀ ਸਹਾਇਤਾ ਪ੍ਰਣਾਲੀ ਵਧੇਰੀ ਚੰਗੀ ਨਹੀਂ ਹੈ ਕਿਉਂਕਿ ਅਸੀਂ ਲੋਕ ਬਾਰਡਰ ਏਰੀਆ 'ਤੇ ਰਹਿੰਦੇ ਹਾਂ ਸਮੇਂ ਸਮੇਂ 'ਤੇ ਨੈਟਵਰਕ ਕੱਟ ਜਾਂਦਾ ਹੈ ਇਸ ਲਈ ਇੱਥੇ ਤਕਨੀਕੀ ਪ੍ਰਣਾਲੀ ਨੂੰ ਵਧਾਉਣ ਲਈ ਸਹੀ ਕਰਨ ਲਈ ਲੋਕਾਂ ਨੂੰ ਸਮਰਥਨ ਲੈਣ ਲਈ ਸਮਾਜ ਤੋਂ ਸਮਰਥਨ ਪ੍ਰਾਪਤ ਕਰਨ ਲਈ ਸਾਨੂੰ ਬਹੁਤ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਮੇਂ ਸਮੇਂ 'ਤੇ ਵ ਚੰਗੀਆਂ ਤਕਨੀਕੀ ਪ੍ਰਣਾਲੀਆਂ ਦੀ ਵਿਵਸਥਾ ਕਰਨੀ ਪਏਗੀ ਤਕ ਤਕਨੀਕੀ ਪ੍ਰਣਾਲੀ ਦੀ ਚੰਗੀ ਵਿਵਸਥਾ ਲਈ ਸਮਾਜ ਤੋਂ ਸਤਰਕ ਕਰਨ ਲਈ ਸਮਾਜ ਨੂੰ ਸਤਰਕ ਕਰਨ ਲਈ ਸਾਨੂੰ ਇੱਥੋਂ ਦੀ ਸਿਸਟਮ ਨੂੰ ਠੀਕ ਕਰਨਾ ਪਏਗਾ ਕਿਉਂਕਿ ਬਾਰਡਰ ਏਰੀਏ 'ਤੇ ਪਿੰਡਾਂ ਦੇ ਨੈਟਵਰਕ ਦੀ ਬੜੀ ਪ੍ਰੋਬਲਮ ਆਉਂਦੀ ਹੈ ਇਸ ਲਈ ਉੱਥੇ ਚੰਗੀਆਂ ਤਾਰਾਂ ਚੰਗੇ ਨੈਟਵਰਕ ਸਿਸਟਮ ਨੂੰ ਬਣਾਉਣ ਲਈ ਸਰਕਾਰ ਨੂੰ ਦੇ ਸਮਰਥਨ ਦੀ ਲੋੜ ਹੈ ਜਿਸ ਨੂੰ ਸਮਾਜ ਨੂੰ ਮੁਸ਼ਕਿਲਾਂ ਦਾ ਔਕੜਾਂ ਦਾ ਸ ਸਾਹਮਣਾ ਨਾ ਕਰਨਾ ਪਏ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਬਾਰੇ ਨੈਟਵਰਕ ਬਾਰੇ ਤਕਨੀਕੀ ਸਹਾਇਤਾ ਲਈ ਚੰਗੇ ਚੰਗੇ ਨੈਟਵਰਕ ਸਿਸਟਮ ਸਥਾਪਿਤ ਕਰੇ ਚੰਗੇ ਵੱਡੇ ਟਾਵਰ ਦਾ ਪ੍ਰਯੋਗ ਕਰੇ ਤਾਂ ਕਿ ਲੋਕ ਤਕਨੀਕੀ ਪ੍ਰਣਾਲੀ ਅੱਜ ਦੇ ਵੱਧਦੇ ਯੁੱਗ ਵਿੱਚ ਪ੍ਰ ਪ੍ਰਯੋਗ ਕਰ ਸਕਣ ਅਤੇ ਬਾਕੀ ਲ ਦੇਸ਼ਾਂ ਨਾਲ ਮਿਲ ਸਕਣ ਅਤੇ ਆਪਦੇ ਆਪ ਨੂੰ ਅੱਗੇ ਵਧਾ ਸਕਣ